ਤਸਵੀਰਾਂ ਲੈਣ ਲਈ ਤਾਂ ਬਹੁਤ ਯਾਤਰਾ ਕੀਤੀਆਂ ਨੇ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਕਿ ਸ਼ਿਮਲੇ ਗਏ ਕੁੱਲੂ ਮਨਾਲੀ ਗਏ ਫੇਰ ਅਸੀਂ ਦਮਦਮਾ ਸਾਬ ਗਏ ਓਥੇ ਫੋਟੋਆਂ ਲਈਆਂ ਗੁਰਦਵਾਰਿਆਂ ਵਿੱਚ ਗਏ ਪਰ ਭਾਰਤ ਇੱਕ ਇਹੋ ਜਿਹੀ ਜਗ੍ਹਾ ਹੈਗੀ ਜਿੱਥੇ ਜਿੰਨਾ ਘੁੰਮੋ ਓਨਾ ਥੋੜਾ ਹੈ ਫੋਟੋਆਂ ਖਿੱਚਣ ਲਈ ਚਾਹੇ ਵੈਸੇ ਵੀ ਨੇਚਰ ਦਾ ਬਹੁਤ ਕੁਛ ਹੈਗਾ ਵੀ ਇੰਡੀਆ ਵਿੱਚ ਬੰਬੇ ਗੇਟ ਵੇ ਓਫ ਇੰਡੀਆ ਹੈਗਾ ਦਿੱਲ੍ਹੀ ਵਿੱਚ ਇੰਡੀਆ ਗੇਟ ਹੈਗਾ ਇਮਾਰਤਾਂ ਦੇਖਣ ਲੱਗੇ ਫ਼ੋਟੋ ਖਿੱਚਣ ਲੱਗਿਆਂ ਬੜਾ ਦਿਲ ਕਰਦਾ ਐ ਵੀ ਅਸੀਂ ਜਈਏ ਓਥੇ ਜਾਣਾ ਤੇ ਸਾਰੇ ਪਾਸੇ ਚਾਂਨੇ ਆਂ ਵੀ ਐਥੇ ਵੀ ਚਲੇ ਜਈਏ ਓਥੇ ਵੀ ਚਲੇ ਜਈਏ ਪਰ ਟੂਰ ਕਦੇ ਕਦੇ ਜਦੋਂ ਬਣਦਾ ਹੈਗਾ ਤਾਂ ਅਸੀਂ ਜਰੂਰ ਜਾਨੇ ਹੈਗੇ ਆਂ ਤੇ ਬਾਕੀ ਅਸੀਂ ਜਾਂਦੇ ਆ ਜਾਵਾਂਗੇ ਜਰੂਰ ਜਾਵਾਂਗੇ ਤੇ ਫੋਟੋਆਂ ਖਿੱਚਾਂਗੇ ਫੋਟੋਆਂ ਇੰਡੀਆ ਦੀਆਂ ਫੋਟੋਆਂ ਬਹੁਤ ਵਧੀਆ ਨੇ ਇੰਡੀਆ ਦਾ ਬਹੁਤ ਵਧੀਆ ਬਣਿਆ ਹੋਇਆ ਟੈਕਚਰ ਵਗੈਰਾ ਸਭ ਕੁਝ ਅੱਛਾ ਹੈਗਾ